ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਸਾਨੂੰ ਬਹੁਤ ਤਰੀਕੇ ਅਪਣਾਉਣੇ ਚਾਹੀਦੇ ਹਨ ਜਿਵੇਂ ਕਿ ਸ ਸਰਦੀਆਂ ਦਾ ਮੌਸਮ ਹੋਵੇ ਗਰਮੀਆਂ ਦਾ ਹੋਵੇ ਜਾਂ ਸਭ ਤੋਂ ਵੱਧ ਕੇ ਬਰਸਾਤੀ ਮੌਸਮ ਹੋਵੇ ਪਹਿਲੀ ਗੱਲ ਤਾਂ ਹੈ ਕਿ ਕਿਤੇ ਵੀ ਕੋਈ ਫਾਲਤੂ ਪਾਣੀ ਇਕੱਠਾ ਨਾ ਹੋਣ ਦਿਉ ਘਰਾਂ ਵਿੱਚ ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਖਾਲੀ ਕਰੋ ਕਿਸੇ ਵੀ ਬਾਲਟੀਆਂ ਬਕਸਿਆਂ ਨੂੰ ਪਾਣੀ ਨਾਲ ਭਰ ਕੇ ਅਤੇ ਖੁੱਲ੍ਹੇ ਨਾ ਰੱਖੋ ਕਿਉਂਕਿ ਇਹਨਾਂ ਨੂੰ ਕਰਨ ਵਾਲੇ ਇਹਨਾਂ ਨੂੰ ਫੈਲਾਉਣ ਵਾਲੇ ਜਿਹੜੇ ਮੱਛਰ ਨੇ ਉਹ ਸਾਫ ਪਾਣੀ ਵਿੱਚ ਵੀ ਫੈਲ ਰਹੇ ਨੇ ਇਸ ਕਰਕੇ ਪਾਣੀ ਨੂੰ ਇਕੱਠਾ ਕਰਨ ਦੀ ਲੋੜ ਨਹੀਂ ਉਹ ਸਿਰਫ ਟੈਂਕੀਆਂ ਵਿੱਚ ਵੀ ਹੋ ਅਤੇ ਉਹਨਾਂ ਟੈਂਕੀਆਂ ਨੂੰ ਵੀ ਸਮੇਂ 'ਤੇ ਸਮੇਂ ਸਾਫ਼ ਕਰਨੇ ਜ਼ਰੂਰੀ ਨੇ ਇਸ ਇਹ ਇਸ ਦੇ ਨਾਲ ਇਹ ਹੁੰਦਾ ਹੈ ਕਿ ਤੁਸੀਂ ਜਿਹੜੀਆਂ ਵੀ ਮੌਸਮੀ ਸਬਜ਼ੀਆਂ ਅਤੇ ਫਲ ਆਉਂਦੇ ਨੇ ਉਹਨਾਂ ਦਾ ਸੇਵਨ ਵੀ ਕਰੋ ਘਰ ਦੀ ਰੋਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਬਾਹਰ ਕੱਟੇ ਹੋਏ ਫਲ ਕੱਟੀਆਂ ਹੋਈਆਂ ਸਬਜ਼ੀਆਂ ਬਾਹਰ ਦੇ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਤਾਂ ਕਿ ਬਾਹਰੋਂ ਇਹਨਾਂ ਦੇ ਜਿਹੜੇ ਮਲੇਰੀਆ ਦੇ ਜਾਂ ਡੇਂਗੂ ਬੁਖਾਰ ਦੇ ਜਿਹੜੇ ਵੀ ਹੁੰਦੇ ਹਨ ਮੱਛਰਾਂ ਦੇ ਲਾਰਵੇ ਉਹ ਅਸੀਂ ਆਪਣੇ ਨਾਲ ਆਪਣੇ ਘਰ ਨਾ ਲੈ ਜਾਈਏ ਅਤੇ ਨਾ ਹੀ ਅਸੀਂ ਆਪਣੇ ਘਰਦਿਆਂ ਦੀ ਸਿਹਤ ਦੇ ਨਾਲ ਖਿਲਵਾੜ ਕਰੀਏ